ਸਾਡੇ ਪਿੰਡ ਵਿੱਚ ਜਿਹੜੇ ਆ ਉਹ ਮਤਲਬ ਕਾਫੀ ਸਾਰੇ ਬਿਜਨਸ ਕੀਤੇ ਜਾਂਦੇ ਆ ਪਰ ਸ਼ਹਿਰਾਂ ਦੇ ਮੁਕਾਬਲੇ ਸ਼ਹਿਰਾਂ ਵਿੱਚ ਜਿਹੜੇ ਆ ਉਹ ਬਹੁਤ ਸਾਰੇ ਬਿਜਨਸ ਹੁੰਦੇ ਹੈ ਜਿੱਦਾਂ ਕਿ ਸ਼ੋਪਸ ਵਗੈਰਾ ਵੱਡੀਆਂ ਵੱਡੀਆਂ ਸ਼ੋਅਰੂਮਸ ਵਗੈਰਾ ਉਹ ਸਭ ਪਿੰਡਾਂ ਵਿੱਚ ਮਤਲਬ ਜ਼ਿਆਦਾ ਨਹੀਂ ਹੁੰਦਾ ਪਰ ਫਿਰ ਵੀ ਉਹ ਅੱਜ ਵਾਲੇ ਟਾਈਮ ਵਿੱਚ ਜਿਹੜੇ ਆ ਪਿੰਡਾਂ ਵਿੱਚ ਕਈ ਸਾਰੇ ਲੋਅ ਲੈਵਲ ਦੇ ਜਿਹੜੇ ਬਿਜਨਸ ਆ ਉਹ ਆ ਗਏ ਆ ਜਿੱਦਾਂ ਕਿ ਸ਼ੋ ਸ਼ੋਪਸ ਵਗੈਰਾ ਕਰਿਆਨਾ ਵਗੈਰਾ ਔਰ ਔਰ ਡੇਅਰੀ ਮਤਲਬ ਕਰਿਆਨਾ ਦੇ ਆਉਣ ਨਾਲ ਜਿਹੜੇ ਲੋਕਾਂ ਨੂੰ ਕੋਈ ਵੀ ਘਰ ਦੀ ਚੀਜ਼ ਲੈਣ ਲਈ ਜ਼ਿਆਦਾ ਦੂਰ ਨਹੀਂ ਜਾਣਾ ਮਤਲਬ ਸ਼ਹਿਰ ਨਹੀਂ ਜਾਣਾ ਪੈਂਦਾ ਉਹਨਾਂ ਨੂੰ ਈਜ਼ਲੀ ਜਿਹੜੀ ਆ ਉਹ ਪਿੰਡ ਵਿੱਚ ਹੀ ਪ੍ਰੋਵਾਈਡ ਹੋ ਜਾਂਦੀ ਹੈ ਜਿੱਦਾਂ ਡੇਅਰੀ ਐਡ ਡੇਅਰੀ ਵਿੱਚ ਜਿਹੜਾ ਦੁੱਧ ਵਗੈਰਾ ਮਤਲਬ ਲੋਕਾਂ ਨੂੰ ਜਿਹੜਾ ਉਹ ਈਜ਼ਲੀ ਮਿਲ ਜਾਂਦਾ ਉਹਨਾਂ ਨੂੰ ਜਿਹੜਾ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ ਉਹਦੇ ਲਈ ਮਤਲਬ ਕਈ ਸਾਰੀਆਂ ਕਈ ਸਾਰੇ ਪਿੰਡਾਂ ਵਿੱਚ ਦੇਖ ਲਓ ਅਤੇ ਕਰਿਆਨਾ ਵਾਲਾ ਜਿਹੜਾ ਬਿਜਨਸ ਆ ਉਹ ਕਾਫੀ ਫੇਮਸ ਹੈ ਮਤਲਬ ਇੱਕ ਪਿੰਡ ਵਿੱਚ ਕਾਫੀ ਸਾਰੀਆਂ ਕਰਿਆਨਾ ਦੀਆ ਜਿਹੜੀਆਂ ਉਹ ਸ਼ੋਪਸ ਹੁੰਦੀਆਂ ਅਤੇ ਤਾਂ ਜੋ ਜਿਹੜੇ ਲੋਕਾਂ ਨੂੰ ਜਿਹੜਾ ਈਜ਼ਲੀ ਜਿਹੜੇ ਉਹ ਪ੍ਰੋਡਕਟ ਮਿਲ ਸਕਣ ਧੰਨਵਾਦ